ਮੈਂ ਸਰਹਿੰਦ ਫਤਿਹਗੜ੍ਹ ਸਾਹਿਬ ਚਿੱਤਰਕਾਰੀ ਦੀ ਕਲਾਸ ਲਗਾਈ ਜਿਸ ਵਿੱਚ ਸਾਨੂੰ ਲਾਈਵ ਪੇਂਟਿੰਗ ਸਟਿਲ ਪੇਂਟਿੰਗ ਗਲਾਸ ਪੇਂਟਿੰਗ ਅਤੇ ਪੋਟਰੇਟ ਵਗੈਰਾ ਬਣਾਉਣੇ ਸਿਖਾਏ ਗਏ ਜੋ ਕਿ ਇੱਕ ਬਹੁਤ ਹੀ ਵਧੀਆ ਅਨੁਭਵ ਸੀ ਚਿੱਤਰਕਾਰੀ ਨਾਲ਼ ਮਨ ਨੂੰ ਸਕੂਨ ਮਿਲਦਾ ਹੈ ਇਸ ਨਾਲ਼ ਕ੍ਰੀਏਟਿਵਿਟੀ ਵੀ ਵਧਦੀ ਹੈ ਆਪਣੀ ਕਲਪਨਾ ਨਾਲ਼ ਕੁਦਰਤ ਦੇ ਸੋਹਣੇ ਦ੍ਰਿਸ਼ ਬਣਾ ਕੇ ਮਨ ਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ ਪੇਂਟਿੰਗਸ ਨੂੰ ਵੇਚ ਕੇ ਪੈਸੇ ਵੀ ਕਮਾਏ ਜਾ ਸਕਦੇ ਹਨ ਅਤੇ ਇੱਕ ਕਮਾਈ ਦਾ ਵੀ ਵਧੀਆ ਸਾਧਨ ਹੈ ਚਿੱਤਰਕਾਰੀ ਨਾਲ਼ ਮਨ ਸ਼ਾਂਤ ਅਤੇ ਸਥਿਰ ਰਹਿੰਦਾ ਹੈ ਮੈਨੂੰ ਇਹ ਬਹੁਤ ਹੀ ਵਧੀਆ ਲੱਗਿਆ